ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਆਪਣੇ ਬੱਚੇ ਬਾਰੇ ਉਹਨਾਂ ਦੇ ਰਿਜਲਟ ਪਤਾ ਕਰਨਾ ਆਈ ਹਾਂ ਮੇਰੇ ਬੱਚੇ ਦਾ ਨਾਮ ਰਿਬਿਕਾ ਕੌਰ ਆ ਹਾਂਜੀ ਹਾਂਜੀ ਹਾਂਜੀ ਓਕੇ ਹਾਂਜੀ ਟਿਵਿਸ਼ਨ 'ਤੇ ਰਖਵਾਇਆ ਵਾ ਜਾਈਦਾ ਵਾ ਟਿਵਿਸ਼ਨ ਮੈਮ ਕੋਲ ਵੀ ਜਾਈਦਾ ਵਾ ਉਹਨਾਂ ਨਾਲ ਵੀ ਗੱਲ ਕਰੀ ਦੀ ਆ ਹਾਂਜੀ ਸਟੱਡੀ ਘਰੇ ਵੀ ਕਰਵਾਈ ਦੀ ਆ ਇਹਨਾਂ ਦਾ ਹੋਮ ਵਰਕ ਵੀ ਚੈੱਕ ਕਰੀਦਾ ਵਾ ਜਾਈਦਾ ਵਾ ਸਕੂਲ ਵੀ ਜਾਈਦਾ ਵਾ ਟੀਚਰ ਕੋਲ ਸਟੂਡੈਂਟ ਕੋਲ ਅਤੇ ਉਹਦੇ ਕੋਲ ਵੀ ਜਾਈਦਾ ਵਾ ਟਿਵਿਸ਼ਨ ਟੀਚਰ ਕੋਲ ਵੀ ਹਾਂਜੀ ਬਥੇਰਾ ਮੈਮ ਘਰੇ ਵੀ ਝਿੜਕੀ ਦਾ ਬੱਚੇ ਤੁਹਾਨੂੰ ਪਤਾ ਸ਼ਰਾਰਤੀ ਹੁੰਦੇ ਸਾਰੇ ਸ਼ਰਾਰਤਾਂ ਤਾਂ ਕਰਦੇ ਹੀ ਆ ਸਾਰੇ ਬੱਚੇ ਓਕੇ ਮੈਮ ਓਕੇ ਕਰ ਦਿੰਦੇ ਓਕੇ ਮੈਮ